ਪੰਜਾਬ ਦੇ ਲੋਕ ਬਹੁਤ ਸਾਰੀਆਂ ਖੇਡਾਂ ਖੇਡਦੇ ਹਨ ਉਹ ਆਪਣੇ ਮਨ ਪਰਚਾਵੇ ਲਈ ਖੇਡਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਸਾਡੀਆਂ ਖੇਡਾਂ ਪ੍ਰਚਲਤ ਹਨ ਜਿਵੇਂ ਕਿ ਖੋ ਖੋ ਕ੍ਰਿਕਟ ਬੈਡਮਿੰਟਨ ਵਾਲੀਬੋਲ ਬਾਸਕਿਟਬੋਲ ਮੇਰੀਆਂ ਵੀ ਬਹੁਤ ਸਾਰੀਆਂ ਖੇਡਾਂ ਮਨਪਸੰਦ ਹਨ ਪਰ ਮੈਨੂੰ ਸਭ ਤੋਂ ਜ਼ਿਆਦਾ ਬੈਡਮਿੰਟਨ ਖੇਡਣਾ ਪਸੰਦ ਹੈ ਕਿਉਂਕਿ ਉਹਦੇ ਨਾਲ਼ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਉਹਨੂੰ ਘਰ ਵਿੱਚ ਹੀ ਆਪਣੇ ਪਰਿਵਾਰ ਵਿੱਚ ਖੇਡ ਸਕਦੇ ਹਾਂ ਮੈਂ ਜ਼ਿਆਦਾਤਰ ਵਿਹਲੇ ਸਮੇਂ ਵਿੱਚ ਸ਼ਾਮ ਨੂੰ ਆਪਣੇ ਬੱਚਿਆਂ ਦੇ ਨਾਲ਼ ਬੈਡਮਿੰਟਨ ਖੇਡਣਾ ਪਸੰਦ ਕਰਦੀ ਹਾਂ ਅਤੇ ਅਸੀਂ ਸਾਰੇ ਪਰਿਵਾਰ ਸਾਰੇ ਰਲ਼ ਮਿਲ ਕੇ ਹੀ ਇਸ ਖੇਡ ਨੂੰ ਖੇਡਦੇ ਹਾਂ ਪਹਿਲਾਂ ਮੈਂ ਇਸ ਨੂੰ ਦੇਖਦੀ ਸੀ ਜਦੋਂ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਂ ਇਹਨੂੰ ਦੇਖ ਕੇ ਹੀ ਸਾਰਾ ਕੁਛ ਸਿੱਖਦੀ ਸੀ ਪਰ ਹੁਣ ਜਦੋਂ ਮੈਨੂੰ ਇਸ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਮੈਂ ਹੁਣ ਆਪਣੇ ਪਰਿਵਾਰ ਦੇ ਨਾਲ਼ ਸ਼ਾਮ ਨੂੰ ਹਰ ਰੋਜ਼ ਖੇਡਦੀ ਹਾਂ ਤਾਂ ਕਿ ਉਹਦੇ ਨਾਲ਼ ਮੇਰਾ ਸਰੀਰ ਤੰਦਰੁਸਤ ਰਹਿ ਸਕੇ ਅਤੇ ਅਸੀਂ ਫਿੱਟ ਰਹਿ ਸਕੀਏ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੋ ਵੀ ਕਿਸੇ ਦੀ ਮਨਪਸੰਦ ਖੇਡ ਹੈ ਉਹ ਆਪਣੀ ਖੇਡ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣ ਅਤੇ ਹਰ ਰੋਜ਼ ਖੇਡ ਕੇ ਆਪਣੇ ਸਰੀਰ ਨੂੰ ਫਿਟ ਰੱਖ ਸਕਣ ਅਤੇ ਆਪਣੇ ਮਨ ਪਰਚਾਵੇ ਲਈ ਇਹਨਾਂ ਖੇਡਾਂ ਦੀ ਵਰਤੋਂ ਕਰਨ ਪੰਜਾਬ ਵਿੱਚ ਜ਼ਿਆਦਾਤਰ ਲੋਕ ਇਹੀ ਖੇਡਾਂ ਰਾਹੀਂ ਹੀ ਕੁਛ ਮੁਕਾਮ ਹਾਸਿਲ ਕਰ ਚੁੱਕੇ ਹਨ ਕੁਛ ਲੋਕ ਅਜਿਹੇ ਵੀ ਹਨ ਜੋ ਖੇਡਾਂ ਦੇ ਕਰਕੇ ਹੀ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਵੀ ਇੰਨੇ ਪ੍ਰਸੱਧ ਪ੍ਰਸਿੱਧ ਹੋ ਚੁੱਕੇ ਹਨ ਕਿ ਉਹ ਆਪਣੇ ਖੇਡਾਂ ਨੂੰ ਹੀ ਇੱਕ ਕਿੱਤਾ ਮੰਨ ਚੁੱਕੇ ਹਨ ਜਿਵੇਂ ਕਿ ਸਚਿਨ ਤੇਂਦੁਲਕਰ ਇੱਕ ਕ ਮੁੱਖ ਕ੍ਰਿਕਟਰ ਹੈ ਉਹ ਆਪਣੀ ਖੇਡ ਰਾਹੀਂ ਹੀ ਦੁਨੀਆਂ ਵਿੱਚ ਬਹੁਤ ਪ੍ਰਚਲਿਤ ਹੈ ਇਸੇ ਤਰ੍ਹਾਂ ਬਹੁਤ ਸਾਰੇ ਕ ਖੇਡਾਂ ਇੱਦਾਂ ਦੀਆਂ ਹਨ ਜਿਨ੍ਹਾਂ ਨਾਲ਼ ਅਸੀਂ ਅਪ ਇੱਕ ਮੁਕਾਮ ਹਾਸਿਲ ਕਰ ਸਕਦੇ ਹਾਂ ਚਾਹੇ ਉਹ ਖੇਡਣਾ ਖੇਡ ਹੋਵੇ ਚਾਹੇ ਉਹ ਕੋਈ ਵੀ ਕਿੱਤਾ ਹੋਵੇ ਕੋਈ ਵੀ ਕਿੱਤਾ ਕਿਸੇ ਕਿੱਤੇ ਨਾਲ਼ੋਂ ਵੱਖ ਨਹੀਂ ਹੁੰਦਾ ਇਸ ਕਰਕੇ ਅਸੀਂ ਖੇਡਾਂ ਰਾਹੀਂ ਆਪਣਾ ਮਨ ਪਰਚਾਵਾ ਕਰ ਸਕਦੇ ਹਾਂ ਅਤੇ ਨਾਲ਼ ਦੀ ਨਾਲ਼ ਹੀ ਅਸੀਂ ਉਹਨੂੰ ਇੱਕ ਕਿੱਤਾ ਵੀ ਮੰਨ ਕੇ ਆਪਣੇ ਜੀਵਨ ਵਿੱਚ ਅਪਣਾ ਸਕਦੇ ਹਾਂ